ਸਤਿ ਸ਼੍ਰੀ ਅਕਾਲ ਸਰ ਸਰ ਅਮਰਦੀਪ ਕੈਟਰਿੰਗ ਤੋਂ ਬੋਲਦੇ ਹੋ ਜੀ ਸਰ ਸਿਸਟਰ ਦੀ ਰਿੰਗ ਸੈਰੇਮਨੀ ਸੀ ਉਸਦਾ ਫੂਡ ਔਡਰ ਕਰਵਾਉਣਾ ਸੀ ਮੈਂ ਮੈਂ ਸਰ ਫਤਿਹਗੜ੍ਹ ਸਾਹਿਬ ਤੋਂ ਹਾਂ ਜੀ ਸੌ ਕੁ ਬੰਦਿਆਂ ਦਾ ਚਾਹੀਦਾ ਸੀ ਆਪਾਂ ਨੂੰ ਜੀ ਹਾਂਜੀ ਅਤੇ ਆਪਣੇ ਕੋਲ ਵਧੀਆ ਹੁੰਦੇ ਜੀ ਇਹ ਕੋਆਲਟੀ ਵਧੀਆ ਚਾਹੀਦੀ ਜੀ ਆਪਾਂ ਨੂੰ ਐਨ ਠੀਕ ਹੈ ਪਤਾ ਕੀ ਹੈ ਸਰ ਪਿਛਲੀ ਵਾਰ ਨਾ ਮਤਲਬ ਮੇਰਾ ਬਡੇ ਸੀ ਨਾ ਬਡੇ 'ਤੇ ਤੁਹਾਡੀ ਏਜੰਸੀ ਤੁਸੀਂ ਤਾਂ ਜਦੋਂ ਨਹੀਂ ਹੋਣੇ ਸ਼ਾਇਦ ਹੋਰ ਸੀ ਉਹਨਾਂ ਸ਼ਾਇਦ ਉਹ ਹੋਗੀ ਅਤੇ ਉਹਨਾਂ ਦਾ ਕਰਵਾਈ ਸੀ ਬਿਲਕੁੱਲ ਘਟੀਆ ਕੋਆਲਟੀ ਆਈ ਸੀ

ਠੀਕ ਹੈ ਸਰ ਠੀਕ ਹਾਂਜੀ ਠੀਕ ਹੈ ਸਰ ਉਹ ਹੀ ਆ ਨਾ ਫਿਰ ਇੱਕ ਤਾਂ ਬੱਸ ਥੋੜਾ ਬਹੁਤਾ ਚਾਹੇ ਵੱਧ ਹੀ ਹੋਵੇ ਪੰਜ ਚਾਰ ਜਣਿਆ ਦੀ ਜੇ ਵੱਧ ਸੌ ਦਾ ਕਰਾਵਾਗੇ ਆਪਾਂ ਸੌ ਤੋਂ ਇੱਕ ਸੌ ਦਸ ਦਾ ਹੋਵੇ ਉਹ ਵੀ ਚੱਲ ਜਾਵੇਗਾ ਜੀ ਕੋਈ ਨੀ ਪੇਮੈਂਟ ਆਪਾਂ ਤੁਹਾਨੂੰ ਪੂਰੀ ਜਿੱਦਾਂ ਤੁਹਾਡੀ ਹੋਊਗੀ ਉੱਦਾਂ ਕਰਾਂਗੇ ਅਤੇ ਬਸ ਕੋਆਲਟੀ ਵਧੀਆ ਹੋਵੇ ਜੀ

ਥਾਲੀ ਦੇ ਸਰ ਇੱਕ ਤਾਂ ਸ਼ਾਹੀ ਪਨੀਰ ਕਰ ਦਿਓ ਜੀ ਸ਼ਾਹੀ ਪਨੀਰ ਚਾਹੀਦਾ ਜੀ ਮਿਕਸ ਵੈੱਜ ਕਰ ਦਿਓ ਜੀ ਅਤੇ ਇੱਕ ਚੌਲ ਕਰ ਦਿਓ ਜੀ ਨਾਲ਼ ਫਿਰ ਰੋਟੀ ਚਾਹੀਦੀ ਹੈ ਬਸ ਜੀ ਇੱਕ ਮਿੱਠੇ ਕਰ ਦਿਓ ਕੁਛ ਜੀ ਮਿੱਠੇ 'ਚ ਗੁਲਾਬ ਜਾਮਣ ਕਰ ਲਿਓ ਗਰਮ ਗੁਲਾਬ ਜਾਮਣ ਜੀ ਹਾਂਜੀ ਸਰ ਇਹ ਸਰ ਆਪਾਂ ਨੂੰ ਚਾਹੀਦੇ ਹੈ ਦਸ ਤਰੀਕ ਦੇ ਦਸ ਤਰੀਕ ਨੂੰ ਚਾਹੀਦਾ ਜੀ

ਹਾਂਜੀ ਹਾਂਜੀ ਸਰ ਆਹ ਨੰਬਰ ਮੇਰਾ ਹੀ ਹੈ ਅਤੇ ਕੱਲ੍ਹ ਨੂੰ ਕੋਲ ਕਰ ਲਿਓ ਮੈਨੂੰ ਮੈਂ ਤੁਹਾਨੂੰ ਬਾਕੀ ਉਹ ਕਰਦਾਂਗਾ ਬਾਕੀ ਜੇ ਮੇਰੇ ਗੇੜਾ ਲੱਗਿਆ ਮੈਂ ਗੇੜਾ ਵੀ ਮਾਰੂਗਾ ਜੀ ਇੱਥੇ ਠੀਕ ਹੈ ਸਰ ਓਕੇ ਜੀ